ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਮੈਨੂੰ ਤਾਂ ਵੈਸੇ ਘੁੰਮਣ ਦਾ ਬਹੁਤ ਹੀ ਜ਼ਿਆਦਾ ਸੌਕ ਹੈ ਮੈਂ ਆਪਣੇ ਫੈਮਲੀ ਫਰੈਂਡਸ ਮਿੱਤਰਾਂ ਦੋਸਤਾਂ ਨਾਲ ਹਰ ਮਹੀਨੇ ਹੀ ਕਿਤੇ ਨਾ ਕਿਤੇ ਘੁੰਮਣ ਜਾਂਦੀ ਹਾਂ ਮੈਂ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਕ ਹੈ ਘੁੰਮਣ ਦਾ ਮੈਂ ਹੁਣ ਹੁਣ ਪਿੱਛੇ ਜਿਹੇ ਆਪਣੇ ਦੋਸਤਾਂ ਨਾਲ ਵੰਡਰਲੈਂਡ ਘੁੰਮਣ ਲਈ ਗਈ ਸੀ ਓਥੇ ਆਪਾਂ ਬਹੁਤ ਹੀ ਜ਼ਿਆਦਾ ਇੰਜੋਆਏ ਕੀਤਾ ਓਥੇ ਵੋਟਰ ਪਾਰਕ 'ਚ ਆਪਾਂ ਸਵੀਮਿੰਗ ਵਗੈਰਾ ਕੀਤੀ ਬਹੁਤ ਹੀ ਜ਼ਿਆਦਾ ਝੁੱਲੇ ਲਏ ਖਾਦਾ ਪੀਤਾ ਡਾਂਸ ਵਗੈਰਾ ਕੀਤਾ ਬਹੁਤ ਜ਼ਿਆਦਾ ਇੰਜੋਆਏ ਕੀਤਾ ਵੈਸੇ ਤਾਂ ਘਰਦਿਆਂ ਨਾਲ ਜਾ ਕੇ ਵੀ ਬਹੁਤ ਇੰਜੋਆਏ ਹੁੰਦਾ ਪਰ ਮੈਂ ਆਪਣੇ ਘਰਦਿਆਂ ਨਾਲ ਜ਼ਿਆਦਾ ਮਤਲਬ ਮੰਦਰਾਂ ਤੀਰਥ ਸਥਾਨਾਂ ਵਗੈਰਾ 'ਤੇ ਜਾਂਦੇ ਹਾਂ ਦੂਰ ਦੂਰ ਉਹਨਾਂ ਨਾਲ ਹੀ ਜਾਈਦਾ ਜਿਵੇਂ ਸ਼ਿਮਲਾ ਡਲਹੋਜੀ ਆਦਿ ਸਥਾਨ ਮੈਂ ਆਪਣੇ ਦੋਸਤਾਂ ਨਾਲ ਵੀ ਬਹੁਤ ਦੂਰ ਦੂਰ ਵਗੈਰਾ ਕਿਤੇ ਨਾ ਕਿਤੇ ਜਾਂਦੀ ਰਹਿੰਦੀ ਹਾਂ ਹਮੇਸ਼ਾ ਅਤੇ ਮੈਂ ਮੈਨੂੰ ਘੁੰਮਣਾ ਬਹੁਤ ਪਸੰਦ ਲੱਗਦਾ ਚੰਗਾ ਲੱਗਦਾ ਘਰਦਿਆਂ ਨਾਲ ਵੀ ਬਹੁਤ ਵਾਰ ਗਈ ਹਾਂ ਅਤੇ ਹੁਣ ਧੰਨਵਾਦ